ਹੈਲੋ ਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ ਅਸੀਂ ਨਾ ਕੂਕਰ ਲੈਣਾ ਸੀ ਅਤੇ ਉਹ ਸਾਨੂੰ ਦਿਖਾ ਸਕਦੇ ਤੁਸੀਂ ਤੁਸੀਂ ਮਤਲਬ ਜਿਹੜੀ ਵੀ ਕੰਪਨੀ ਤੁਹਾਡੇ ਕੋਲ ਹੈ ਸਾਨੂੰ ਦਿਖਾ ਦਿਉ ਇੱਕ ਦੋ ਨਹੀਂ ਜਿਹੜੀ ਮਤਲਬ ਵਧੀਆ ਲੇਟੈਸਟ ਚਲਦੀ ਪਈ ਉਹ ਕੰਪਨੀ ਦੱਸੋ ਸਾਨੂੰ ਹਾਂਜੀ ਕੁਕਿੰਗ ਦਾ ਹਾਂਜੀ ਹਾਂਜੀ ਦਿਖਾਓ ਤੁਸੀਂ ਸਾਨੂੰ ਹਾਂਜੀ ਅਤੇ ਇਹਨਾਂ ਦੇ ਰੇਟ ਕਿੰਨੇ ਕਿੰਨੇ 'ਤੇ ਸਟਾਟ ਹੁੰਦੇ ਜੀ ਇਹ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਨਹੀਂ ਡਿਸਕਾਊਂਟ ਤੁਸੀਂ ਦੱਸ ਦਿਉ ਨਾ ਥੋੜ੍ਹਾ ਜਿਹਾ ਫੇਰ ਅਸੀਂ ਉਹਦੇ ਅਕੋਰਡਿੰਗ ਹੀ ਲਵਾਂਗੇ ਹਾਂਜੀ ਸੌ ਦੋ ਸੌ ਨਹੀਂ ਹੁਣ ਤੁਸੀਂ ਜ਼ਿਆਦਾ ਕਰੋ ਹਾਂਜੀ ਅਤੇ ਸਾਨੂੰ ਨਾਲ ਨਾ ਬਿੱਲ ਵੀ ਚਾਹੀਦਾ ਐਕਚੁਲੀ ਅਸੀਂ ਨਾ ਉਹ ਨਾ ਬਾਹਰ ਭੇਜਣਾ ਸਮਾਨ ਅਤੇ ਹਾਂਜੀ ਅਤੇ ਉਹ ਨਾ ਹੋਰ ਸਮਾਨ ਹੈ ਇਦੂ ਇਲਾਵਾ ਹੋਰ ਵੀ ਸਾਨੂੰ ਸਮਾਨ ਚਾਹੀਦਾ ਹਾਂਜੀ ਹਾਂਜੀ ਸਾਨੂੰ ਨਾ ਉਹ ਥੋੜ੍ਹਾ ਜਿਹਾ ਮਤਲਬ ਜਿਹੜਾ ਕਿਚਨ ਸੈੱਟ ਹੁੰਦਾ ਨਾ ਪੂਰਾ ਬਰਤਨ ਦਾ ਉਹ ਵੀ ਚਾਹੀਦਾ ਸਾਨੂੰ ਸਟੀਲ ਦਾ

ਹਾਂਜੀ ਅਤੇ ਟਾਈਮ ਕਿੰਨਾ ਦੱਸੋ ਤੁਸੀਂ ਸ਼ੋਪ ਦਾ ਕਿੰਨੇ ਵਜੇ ਮੋਰਨਿੰਗ ਟਾਈਮ ਹਾਂਜੀ ਚਲੋ ਠੀਕ ਹੈ ਫੇਰ ਅਸੀਂ ਨਾ ਪਰਸੋਂ ਆਉਂਦੇ ਹਾਂ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ